ਵੈਲ ਬੈਂਕਸ ਦਾ ਤਾਂ ਕੰਮ ਹੀ ਇਹ ਹੁੰਦਾ ਵੀ ਉਹ ਆਪਾਂ ਨੂੰ ਸਰਵਿਸ ਪ੍ਰੋਵਾਈਡ ਕਰਨ ਆਪਾਂ ਮੇਨਲੀ ਬੈਂਕ ਵਿੱਚ ਜਾਂਦੇ ਹਾਂ ਵੀ ਆਪਾਂ ਨੇ ਸੇਵਿੰਗਸ ਅਕਾਊਂਟ ਕਰੰਟ ਅਕਾਊਂਟ ਵਿੱਚ ਆਪਾਂ ਮੇਨਲੀ ਆਪਾਂ ਪੈਸੇ ਜਮ੍ਹਾਂ ਕਰਾਂਦੇ ਹਾਂ ਆਮ ਜਨਤਾ ਦਾ ਗੱਲ ਕਰੀਏ ਇਸ ਤੋਂ ਇਲਾਵਾ ਜਿਹੜੇ ਆਪਣੇ ਬੈਂਕਸ ਹੈ ਉਹ ਆਪਾਂ ਨੂੰ ਲੋਨਸ ਪ੍ਰੋਵਾਈਡ ਕਰਦੇ ਆ ਮਿਊਚੁਅਲ ਫੰਡਸ ਆਪਾਂ ਨੂੰ ਕਾਰਡਸ ਇਹ ਜਿਵੇਂ ਏ ਟੀ ਐਮ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਾਂ ਗਰੀਨ ਕਾਰਡ ਹੋਰ ਵੀ ਬਹੁਤ ਸਾਰੇ ਕਾਰਡਸ ਹੁੰਦੇ ਜਿਹੜੇ ਆਪਾਂ ਨੂੰ ਪ੍ਰੋਵਾਈਡ ਕਰਦੇ ਹੈ ਠੀਕ ਹੈ ਅਤੇ ਆਪਾਂ ਨੂੰ ਜਿਵੇਂ ਆਪਾਂ ਨੂੰ ਕੋਈ ਵੀ ਲੋਨ ਚਾਹੀਦਾ ਹੈ ਲੋਨ ਆਪਾਂ ਕਿਸੇ ਮਰਜ਼ੀ ਚੀਜ਼ ਦਾ ਲੈ ਸਕਦੇ ਹਾਂ ਪਰ ਉਹਦੇ ਲਈ ਕੁਛ ਕੁ ਪ੍ਰੋਸੀਜਰ ਹੁੰਦਾ ਹੈ ਕੁਛ ਕੁ ਰਿਕਵਾਇਰਮੈਂਟਸ ਹੁੰਦੀਆਂ ਉਹ ਆਪਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਅਤੇ ਬੈਂਕ ਆਪਣੇ ਪੂਰੀ ਹੈਲਪ ਕਰਦਾ ਆਪਾਂ ਨੂੰ ਸਾਰਾ ਪ੍ਰੋਸੀਜਰ ਸਮਝਾਉਂਦਾ ਹੈ ਅਤੇ ਜਿਵੇਂ ਕਿ ਮੰਨ ਲਉ ਹਾਊਸ ਲੋਨ ਲੈਣਾ ਹੈ ਤਾਂ ਆਪਾਂ ਨੂੰ ਪ੍ਰੋਪਰਟੀ ਮਤਲਬ ਦਿਖਾਉਣੀ ਪਊਗੀ ਅਤੇ ਪੂਰਾ ਆਪਣਾ ਦਿਖਾਉਣਾ ਪਊਗਾ ਵੀ ਆਹ ਆਪਾਂ ਪੈਸਾ ਜਿਹੜਾ ਉਸ ਚੀਜ਼ ਲਈ ਹੀ ਯੂਸ ਕਰਾਂਗੇ ਅਤੇ ਜਿਵੇਂ ਆਪਣਾ ਐਜੂਕੇਸ਼ਨਲ ਲੋਨ ਹੈ ਅੱਜ ਕੱਲ੍ਹ ਜਿਵੇਂ ਬੱਚੇ ਬਾਹਰ ਜਾ ਰਹੇ ਹੈ ਤਾਂ ਐਜੂਕੇਸ਼ਨਲ ਲੋਨ ਬਹੁਤ ਜ਼ਿਆਦਾ ਪਾਪੂਲਰ ਹੋਇਆ ਪਿਆ ਹੈ

ਅਤੇ ਇਸ ਤੋਂ ਇਲਾਵਾ ਜਿਹੜੀ ਮਿਊਚਲ ਫੰਡਸ ਆ ਜਿਵੇਂ ਅੱਜ ਕੱਲ੍ਹ ਟਰੇਡਿੰਗ ਟਰੈਂਡ ਵਿੱਚ ਹੈ ਹਰ ਕੋਈ ਟ੍ਰੇਡਿੰਗ ਕਰਦਾ ਅੱਜ ਕੱਲ੍ਹ ਕਿਉਂਕਿ ਪਹਿਲਾਂ ਦੇ ਜ਼ਮਾਨੇ 'ਚ ਮੰਨਦੇ ਸੀ ਵੀ ਟਰੇਡਿੰਗ ਘੱਟ ਹੁੰਦੀ ਸੀ ਪਰ ਹੁਣ ਵਾਲੇ ਜ਼ਮਾਨੇ ਵਿੱਚ ਟ੍ਰੇਡਿੰਗ ਜ਼ਿਆਦਾ ਹੁੰਦੀ ਹੈ ਤਾਂ ਮਿਊਚੁਅਲ ਫੰਡਸ ਵੀ ਆਪਾਂ ਇੱਕ ਕਹਿ ਸਕਦੇ ਹਾਂ ਟ੍ਰੇਡਿੰਗ ਦਾ ਹੀ ਪਾਰਟ ਹੁੰਦਾ ਜਿਹਦੇ ਵਿੱਚ ਆਪਾਂ ਇਨਵੈਸਟਮੈਂਟ ਕਰਨੀ ਹੁੰਦੀ ਹੈ ਅਤੇ ਬੈਂਕਸ ਇਸ ਚੀਜ਼ ਲਈ ਮਤਲਬ ਆਪਣੀ ਪੂਰੀ ਹੈਲਪ ਕਰਦਾ ਹੈ ਆਪਣੀ ਅਤੇ ਇਸ ਤੋਂ ਇਲਾਵਾ ਆਪਾਂ ਨੂੰ ਅਵੇਅਰ ਵੀ ਕਰਵਾਂਦਾ ਜੇ ਕੋਈ ਨਵੀਂ ਸਕੀਮ ਚੱਲਦੀ ਆ ਤਾਂ ਜਦੋਂ ਵੀ ਆਪਾਂ ਬੈਂਕ ਵਿੱਚ ਜਾਂਦੇ ਤਾਂ ਉਹਦੇ ਪੋਸਟਰ ਲੱਗੇ ਹੁੰਦੇ ਆ ਪੰਜਾਬੀ ਵਿੱਚ ਵੀ ਲੱਗੇ ਹੁੰਦੇ ਇੰਗਲਿਸ਼ 'ਚ ਵੀ ਲੱਗੇ ਹੁੰਦੇ ਜਿਹੜੀ ਵੀ ਆਪਣੀ ਨੇਟਿਵ ਲੈਂਗੁਏਜ ਹੁੰਦੀ ਆ ਉਸ ਲੈਂਗੁਏਜ ਵਿੱਚ ਆਪਣੇ ਲਗ ਲੱਗੇ ਹੁੰਦੇ ਆ ਉਸ ਚੀਜ਼ ਦੇ ਪੋਸਟਰਸ ਅਤੇ ਹ ਬਾਕੀ ਮੇਰਾ ਮੈਂ ਇੱਕ ਵਾਰੀ ਜਦੋਂ ਬੈਂਕ ਵਿੱਚ ਆਪਣਾ ਏ ਟੀ ਐਮ ਅਪਲਾਈ ਕਰਨ ਗਈ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਹਾਡਾ ਏ ਟੀ ਐਮ ਪੰਜ ਦਿਨਾਂ ਵਿੱਚ ਆ ਜੂ ਪਰ ਮੇਰੇ ਸੱਤ ਦਿਨ ਹੋ ਗਏ ਸੀ ਉਹ ਆਇਆ ਨਹੀਂ ਮੈਂ ਬੈਂਕ ਵਿੱਚ ਪਤਾ ਕਰਨ ਗਈ ਸੀ ਪਰ ਉਹ ਕੋਈ ਗੱਲ ਜਿਹੀ ਬਣੀ ਨਹੀਂ ਤਾਂ ਇਸ ਲਈ ਮੈਂ ਐਪਲੀਕੇਸ਼ਨ ਵੀ ਦਿੱਤੀ ਸੀ ਉਹਨਾਂ ਨੂੰ ਪਰ ਗੱਲ ਮਤਲਬ ਬੈਂਕ ਨੇ ਮੇਰਾ ਸਾਥ ਦਿੱਤਾ ਇਸ ਚੀਜ਼ ਵਿੱਚ ਭਾਵੇਂ ਮੈਂ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਐਪਲੀਕੇਸ਼ਨ ਦਾ ਪ੍ਰੋਸੀਜ਼ਰ ਵੀ ਬਹੁਤ ਵਧੀਆ ਚਲਾਇਆ ਉਹਨਾਂ ਨੇ ਬਹੁਤ ਰਿਸਪੈਕਟ ਨਾਲ ਗੱਲ ਕੀਤੀ ਅਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਮੈਨੂੰ ਵੀ ਥੋੜ੍ਹੀ ਜਿਹੀ ਨੋਲਿਜ ਹੋਈ ਵੀ ਕਿਵੇਂ ਆਪਾਂ ਕੀ ਕੁਛ ਕਰ ਸਕਦੇ ਹਾਂ ਆਪਣੀ ਕਸਟਮਰ ਨੂੰ ਕਿੰਗ ਮੰਨਿਆ ਜਾਂਦਾ ਉੱਥੇ ਤਾਂ ਆਪਣੇ ਪੂਰੀ ਹ ਹੈਲਪ ਕੀਤੀ ਜਾਂਦੀ ਆ ਪੂਰੀ ਵਧੀਆ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਆ